ਟੈਕਨੋਲਜੀ ਨੇ ਯਾਤਰਾ ਕਰਨ ਦੇ ਤਰੀਕੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਹਿਲਾਂ ਮਨੁੱਖ ਪੈਦਲ ਹੀ ਆਪਣੀ ਯਾਤਰਾ ਕਰਦਾ ਸੀ ਉਸ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੋਵੇ ਤਾਂ ਪੈਦਲ ਜਾਣਾ ਹੀ ਇੱਕਲੌਤਾ ਸਾਧਨ ਸੀ ਇਸ ਤੋਂ ਬਾਅਦ ਉਸ ਨੇ ਗੱਡੇ ਇ ਇਹਦੇ ਨਾਲ ਆਪਣੀ ਯਾਤਰਾ ਕ ਸ਼ੁਰੂ ਕੀਤੀ ਜਿਸ ਦੇ ਵਿੱਚ ਉਹ ਜਾਂ ਬਲਦਾਂ ਵਗੈ ਆਦਿ ਨੂੰ ਜੋੜ ਕੇ ਉਸਦਾ ਇੱਕ ਰੱਥ ਬਣਾ ਕੇ ਯਾਤਰਾ ਕਰਨ ਲੱਗਾ ਉਸ ਤੋਂ ਬਾਅਦ ਸਾਈਕਲ ਆਏ ਅਤੇ ਸਾਈਕਲ ਨਾਲ ਯਾਤਰਾ ਥੋੜ੍ਹੀ ਹੋਰ ਸ ਸੌਖੀ ਹੋ ਗਈ ਫਿਰ ਜਿਵੇਂ ਜਿਵੇਂ ਇੰਡਸਟਰੀ ਵਧਦੀ ਗਈ ਅਤੇ ਟੈਕਨੋਲਜੀ ਵਿੱਚ ਹੋਰ ਸੁਧਾਰ ਹੁੰਦਾ ਗਿਆ ਤਾਂ ਮਸ਼ੀਨਰੀ ਦੀ ਵਰਤੋਂ ਹੋਣ ਲੱਗੀ ਫਿਰ ਸਕੂਟਰ ਹੋਂਦ ਵਿੱਚ ਆਏ ਸਕੂਟਰ ਨਾਲ ਕਿਲੋਮੀਟਰਾਂ ਦੇ ਸਫ਼ਰ ਵੀ ਆਸਾਨੀ ਗੈਲ ਹੋਣ ਲੱਗੇ ਕੁਛ ਹੋਰ ਟੈਕਨੋਲਜੀ ਵਿਕਸਿਤ ਹੋਣ ਨਾਲ ਮੋਟਰਸਾਈਕਲ ਆਏ ਅਤੇ ਜ਼ਿਆਦਾ ਲੰਬੀ ਦੂਰੀ ਨੂੰ ਵੀ ਘੱਟ ਖਰਚੇ ਉੱਤੇ ਹੋਣ ਲੱਗੀ ਇਸ ਤੋਂ ਬਾਅਦ ਬੱਸਾਂ ਆਈਆਂ ਅਤੇ ਬੱਸਾਂ ਬੱਸਾਂ ਨੇ ਤਾਂ ਯਾਤਰਾ ਨੂੰ ਹੋਰ ਵੀ ਸੌਖੇਲੇ ਸੌਖੀ ਕਰ ਦਿੱਤਾ ਅਤੇ ਜ਼ਿਆਦਾ ਲੰਬੇ ਸਫ਼ਰ ਵੀ ਆਰਾਮ ਗੈਲ ਹੋਣ ਲੱਗ ਪਏ ਉਸ ਤੋਂ ਬਾਅਦ ਟ੍ਰੇਨਾਂ ਆਈਆਂ ਜਿਸ ਨਾਲ ਬਹੁਤ ਜ਼ਿਆਦਾ ਲੰਬੇ ਸਫ਼ਰ ਵੀ ਛੇਤੀ ਹੋਣ ਲੱਗ ਪਏ ਅਤੇ ਹੋਰ ਟੈਕਨੋਲੋਜੀ ਹੋਰ ਵਿਕਸਿਤ ਹੋਣ ਨਾਲ ਬੁੱਲੇਟ ਟ੍ਰੇਨਾਂ ਵੀ ਹੈ ਆ ਗਈਆਂ ਉਸ ਤੋਂ ਬਾਅਦ ਹਵਾਈ ਜਹਾਜ਼ ਵੀ ਆਏ ਜਿਸਦੇ ਗੈਲ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਵੀ ਆਰਾਮ ਗੈਲ ਹੋਣ ਲੱਗੀ ਟੈਕਨੋਲੋਜੀ ਨਾਲ਼ ਯਾਤਰਾ ਬਹੁਤ ਆਸਾਨ ਹੋ ਗਈ ਹੈ